ਹਾਂਜੀ ਸਰ ਅੱਛਾ ਸਰ ਨਵਾਂ ਸ਼ਹਿਰ ਦੇ ਵਿੱਚ ਉਦਾਂ ਤਾਂ ਬਹੁਤ ਸਾਰੇ ਜਗ੍ਹਾ ਹੈਗੀਆਂ ਹੈ ਜਿੱਥੇ ਸਬਜ਼ੀਆਂ ਮਿਲਦੀਆਂ ਹੈਗੀਆਂ ਆ ਬਟ ਮੈਂ ਮੇਨਲੀ ਜਿਹੜੇ ਬਸ ਸਟੈਂਡ ਦੇ ਕੋਲ ਇੱਕ ਸਬਜ਼ੀ ਮੰਡੀ ਹੈਗੀ ਆ ਮੈਂ ਉਥੋਂ ਹੀ ਸਬਜ਼ੀ ਲੈਂਦੀ ਹਾਂ ਅਤੇ ਉੱਥੇ ਇੱਕ ਮਤਲਬ ਕਿ ਉਹਨਾਂ ਦਾ ਨਾਮ ਤਾਂ ਹੁਣ ਮੈਨੂੰ ਚੰਗੀ ਤਰ੍ਹਾਂ ਨਹੀਂ ਯਾਦ ਹੈਗਾ ਆ ਅਤੇ ਉਹਨਾਂ ਤੋਂ ਹੀ ਮੈਂ ਸਬਜ਼ੀ ਲੈਂਦੀ ਹੁੰਦੀ ਹਾਂ ਅਤੇ ਉਹਨਾਂ ਦੇ ਕੋਲ ਸਬਜ਼ੀ ਜਿਹੜੀ ਹੁੰਦੀ ਹੈਗੀ ਉਹ ਬਹੁਤ ਹੀ ਵਧੀਆ ਹੁੰਦੀ ਹੈਗੀ ਹੈ ਅਤੇ ਤਾਜ਼ੀ ਲੈ ਕੇ ਆਉਂਦੇ ਆ ਉਹ ਡੇਲੀ ਐਂਡ ਉਹਨਾਂ ਦੇ ਕੋਲ ਇੱਕ ਹੋਰ ਸਰਵਿਸ ਹੈਗੀ ਆ ਕਿ ਜੇ ਅਸੀਂ ਮਤਲਬ ਕਿ ਬੀਜੀ ਹਾਂ ਸਾਡੇ ਕੋਲ ਨਹੀਂ ਟਾਈਮ ਹੈਗਾ ਆ ਵੀ ਉੱਥੇ ਜਾਣ ਦਾ ਅਤੇ ਉਹ ਘਰ ਦੇ ਵਿੱਚ ਵੀ ਦੇ ਸਕਦੇ ਆ ਸਬਜ਼ੀ ਆ ਕੇ ਅਤੇ ਉਹਨਾਂ ਦੇ ਹਾਂਜੀ ਹੋਮ ਡਿਲੀਵਰੀ ਵੀ ਹੈਗਾ ਆ ਉਹਨਾਂ ਦੇ ਕੋਲ ਹਾਂਜੀ ਹਾਂਜੀ ਮੈਂ ਤਾਂ ਮਤਲਬ ਕਿ ਮੈਨੂੰ ਇੱਕ ਸਾਲ ਹੋ ਗਿਆ ਆ ਮੈਂ ਉਹਨਾਂ ਤੋਂ ਹੀ ਸਬਜ਼ੀ ਲੈਂਦੀ ਹਾਂ ਅਤੇ ਉਹਨਾਂ ਦੀਆਂ ਬਹੁਤ ਵਧੀਆ ਸਬਜ਼ੀ ਹੁੰਦੀ ਆ ਰੇਟ ਜੇ ਦੇਖਿਆ ਜਾਵੇ ਤਾਂ ਜਿੱਦਾਂ ਬਾਕੀ ਦੁਕਾਨਾਂ ਵੀ ਹੁੰਦੀਆਂ ਹੈਗੀਆਂ ਨਾਲ ਉਹ ਬਹੁਤ ਮਤਲਬ ਕਿ ਜ਼ਿਆਦਾ ਰੇਟ ਲਗਾਉਂਦੇ ਹੈਗੇ ਆ ਉਹ ਨੋਰਮਲ ਰੱਖਦੇ ਹੈਗੇ ਮਤਲਬ ਕਿ ਬਹੁਤ ਜ਼ਿਆਦਾ ਜ਼ਿਆਦਾ ਵੀ ਨਹੀਂ ਹੁੰਦਾ ਅਤੇ ਘੱਟ ਵੀ ਨਹੀਂ ਹੁੰਦਾ ਹੈਗਾ ਆ ਸਬਜ਼ੀ ਦੇ ਅਕੋਰਡਿੰਗ ਹੀ ਹੁੰਦਾ ਆ ਹਾਂਜੀ

ਹਾਂਜੀ ਸਰ ਮੈਂ ਸ਼ਾਮ ਨੂੰ ਮਤਲਬ ਕਿ ਫ੍ਰੀ ਹੁੰਦੀ ਹਾਂ ਅਤੇ ਸ਼ਾਮ ਨੂੰ ਮੈਂ ਡੇਲੀ ਸਬਜ਼ੀ ਲੈ ਕੇ ਆਉਂਦੀ ਹਾਂ ਅਤੇ ਸ਼ਾਮ ਨੂੰ ਤੁਸੀਂ ਕਿੰਨੇ ਟਾਈਮ ਵਜੇ ਫਰੀ ਹੋਣਾ ਚਾਰ ਵਜੇ ਤੱਕ ਅਤੇ ਹਾਂਜੀ ਸਰ ਕੋਈ ਗੱਲ ਨਹੀਂ ਮੈਂ ਚਾਰ ਵਜੇ ਚਾਰ ਸਾਢੇ ਚਾਰ ਵਜੇ ਤੱਕ ਤਾਂ ਮੈਂ ਵੀ ਫਰੀ ਹੋ ਜਾਣਾ ਹੈਗਾ ਆ ਅਤੇ ਫਿਰ ਮੈਂ ਤੁਹਾਨੂੰ ਕਾਲ ਕਰ ਲਉਂਗੀ ਹਮ ਠੀਕ ਹੈ ਸਰ ਐਂਡ ਮਤਲਬ ਕਿ ਤੁਹਾਡੇ ਕੋਲ ਆਪਣਾ ਕੋਈ ਵਹੀਕਲ ਹੈਗਾ ਜਾਣ ਦੇ ਲਈ ਅੱਛਾ ਜੀ ਕਿਉਂਕਿ ਮੋਟਰਸਾਈਕਲ ਦੇ ਉੱਥੇ ਟਰੈਫਿਕ ਬਹੁਤ ਹੁੰਦਾ ਹੈਗਾ ਆ ਅਤੇ ਮਤਲਬ ਕਿ ਤੁਸੀਂ ਆਟੋ ਦੇ ਵਿੱਚ ਵੀ ਜਾ ਸਕਦੇ ਹੈਗੇ ਆਪਾਂ ਹਾਂਜੀ ਚਲੋ ਠੀਕ ਹੈ ਸਰ ਅਤੇ ਫਿਰ ਸ਼ਾਮ ਨੂੰ ਫਿਰ ਮੈਂ ਤੁਹਾਨੂੰ ਕਾਲ ਕਰ ਲੂੰਗੀ ਇੱਕ ਵਾਰੀ ਓਕੇ ਸਰ